ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਦਰਸ਼ਨ ਸਿੰਘ ਗੱਲ ਕਰ ਰਿਹਾ ਜੀ ਸਰ ਹਰਨੇਕ ਸਿੰਘ ਗੱਲ ਕਰ ਰਹੇ ਹੋ ਸਰ ਕੀ ਅਪਡੇਟ ਹੈ ਜੀ ਹਾਂਜੀ ਓਕੇ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਸਰ ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਰਨੀ ਚਾਹੁੰਦਾ ਕੰਮ ਤਾਂ ਸਰ ਤੁਹਾਨੂੰ ਐਨ ਪ੍ਰੋਪਰ ਓਕੇ ਰਿਪੋਰਟ ਕਰਕੇ ਮਿਲੇਗਾ ਲੇਕਿਨ ਸਰ ਹੋਰ ਕੋਈ ਗੱਲਬਾਤ ਤੁਸੀਂ ਕਰਨੀ ਹੋਵੇ ਸਰ ਸਰ ਮਾਲ ਟੋਟਲ ਸਰ ਮਾਲ ਦੀ ਕਿੰਨੀ ਕੋਆਨਟੀਟੀ ਕਰਨੀ ਹੈ ਆਪਾਂ ਨੇ ਸਰ ਦੋ ਸੌ ਪਲੱਸ ਕਿੰਨਾ ਕੁ ਵੱਧ ਤੇ ਵੱਧ ਤੁਸੀਂ ਮਤਲਬ ਮੈਨੂੰ ਜਾਣਕਾਰੀ ਦੇ ਸਕਦੇ ਹੋ ਇਸ ਟੌਪਿਕ 'ਤੇ ਹਾਂਜੀ ਸਰ ਹਾਂਜੀ ਹਾਂਜੀ ਸਰ ਮੈਂ ਹਾਂਜੀ ਸਰ ਨਹੀਂ ਸਰ ਵਧੀਆ ਟੀਮ ਤੁਹਾਨੂੰ ਗੁੱਡ ਵਰਕ ਤੁਹਾਨੂੰ ਕੰਮ ਦੇ ਮਾਮਲੇ 'ਚ ਸਰ ਕੋਈ ਸ਼ਿਕਾਇਤ ਨਹੀਂ ਮਿਲੇਗੀ ਹੁਣ ਸਰ ਚਲੋ ਠੀਕ ਹੈ ਸਰ ਫਿਰ ਥੈਂਕ ਯੂ ਸਰ ਥੈਂਕ ਯੂ